ਇੱਕ ਜੁਲਾਈ ਉੱਨੀ ਸੌ ਚੁਰਾਸੀ ਦਸ ਜਨਵਰੀ ਉੱਨੀ ਸੌ ਬਾਹਠ ਉਣੱਤੀ ਨਵੰਬਰ ਉੱਨੀ ਸੌ ਅਠਾਸੀ ਦੋ ਮਾਰਚ ਉੱਨੀ ਸੌ ਛਿਆਸੀ ਬਾਈ ਜੂਨ ਉੱਨੀ ਸੌ ਨੱਬੇ